ਸ਼ਹੀਦ ਊਧਮ ਸਿੰਘ ਇੱਕ ਪ੍ਰਮੁੱਖ ਭਾਰਤੀ ਕ੍ਰਾਂ ਕ੍ਰਾਂਤੀਕਾਰੀ ਹਨ ਜਿਨਾਂ ਨੇ ਉੱਨੀ ਸੌ ਉੱਨੀ ਦੇ ਜਿਲ੍ਹਿਆਂ ਵਾਲੇ ਬਾਗ ਸਾਕੇ ਦਾ ਬਦਲਾ ਲੈਣ ਲਈ ਉੱਨੀ ਸੌ ਚਾਲ੍ਹੀ ਵਿੱਚ ਲੰਡਨ ਵਿੱਚ ਪੰਜਾਬ ਦੇ ਸਾਬਕਾ ਲੈਫਟਨਰ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਕਰਨ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ ਸ਼ਹੀਦ ਊਧਮ ਸਿੰਘ ਦਾ ਜਨਮ ਛੱਬੀ ਦਸੰਬਰ ਅਠਾਰ੍ਹਾਂ ਸੌ ਨੜ੍ਹਿਨਵੇਂ ਨੂੰ ਸੁਨਾਮ ਪੰਜਾਬ ਜੋ ਕਿ ਭਾਰਤ ਦੇ ਵਿੱਚ ਹੈ ਸੰਗਰੂਰ ਕੋਲ ਵਿੱਚ ਜਨਮੇ ਊਧਮ ਸਿੰਘ ਇੱਕ ਸਿਆਸੀ ਤੌਰ 'ਤੇ ਚਾਰਜ ਵਾਲੇ ਮਾਹੌਲ ਵਿੱਚ ਵੱਡਾ ਹੋਇਆ ਜਿੱਥੇ ਉਸਨੇ ਦਰਮਕਾਰੀ ਬ੍ਰਿਟਿਸ਼ ਸ਼ਾਸਨ ਅਤੇ ਭਾਰਤੀਆਂ ਵਿਰੁੱਧ ਕੀਤੇ ਅੱਤਿਆਚਾਰਾਂ ਨੂੰ ਵੇਖਿਆ ਉਸ ਦਾ ਪਰਿਵਾਰ ਜਿਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਜਿੱਥੇ ਜਨਰਲ ਓਡਵਾਇਰ ਨੇ ਦੀ ਰਿਮਾਂਡ ਹੇਠ ਬ੍ਰਿਟਿਸ਼ ਫੌਜਾਂ ਨੇ ਭਾਰਤੀਆਂ ਦੇ ਸ਼ਾਂਤੀਮਾਈ ਇਕੱਠ ਵਿੱਚ ਗੋਲੀਬਾਰੀ ਕੀਤੀ ਜਿਸ ਦੇ ਨਤੀਜੇ ਵਜੋਂ ਸੈਂਕੜਾ ਮੌਤਾਂ ਹੋਈਆਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਅਤੇ ਉਸਦੇ ਵੱਡੇ ਭਰਾ ਮੁਕਤਾ ਸਿੰਘ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਵਿੱਚ ਸੈਂਟਰਲ ਖਾਲਸਾ ਅਨਾਥ ਆਸ਼ਰਮ ਪੁਤਲੀਘਰ ਨੇ ਕੀਤਾ ਸਾਲ ਉੱਨੀ ਸੌ ਅਠਾਰ੍ਹਾਂ ਵਿੱਚ ਊਧਮ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਾਲ ਉੱਨੀ ਸੌ ਉੱਨੀ ਵਿੱਚ ਅਨਾਥ ਆਸ਼ਰਮ ਛੱਡ ਦਿੱਤਾ ਸ਼ਹੀਦ ਉਧਮ ਸਿੰਘ ਨੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਊਧਮ ਸਿੰਘ ਦੇ ਇੱਕ ਜੀਵਨ ਵਿੱਚ ਗਦਰ ਪਾਰਟੀ ਦਾ ਅਹਿਮ ਮੁਕਾਮ ਰਿਹਾ ਹੈ ਅਤੇ ਮਹੱਤਵਪੂਰਨ ਅੰਗ ਸੀਗਾ ਗਦਰ ਪਾਰਟੀ ਇਕ ਪੰਜਾਬੀ ਨੇਤਾਵਾਂ ਦਾ ਸੰਗਠਨ ਸੀ ਜਿਸ ਨੇ ਹਿੰਦੁਸਤਾਨੀਆਂ ਨੂੰ ਬ੍ਰਿਟਿਸ਼ ਰਾਜ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ ਸੀਗਾ ਸ਼ਹੀਦ ਊਧਮ ਸਿੰਘ ਨੂੰ ਜਾਣਿਆ ਜਾਂਦਾ ਉਸ ਆਜ਼ਾਦੀ ਅੰਦੋਲਨ ਦਾ ਇਕ ਮਹੱਤਵਪੂਰਨ ਯੋਧਾ ਸੀਗਾ ਜਿਸ ਨੇ ਜਲ੍ਹਿਆਂਵਾਲਾ ਬਾਗ ਦਾ ਕਤਲੇਆਮ ਦਾ ਬਦ ਬਦਲਾ ਲਿਆ ਸੀਗਾ ਸ਼੍ਰੀ ਗੁਰੂਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮ ਮਸੀਹੇ ਮੀਤ ਗਈਆਂ ਅੱਖਾਂ ਵਿੱਚ ਪਿਆਰ ਅਤੇ ਭਰੋਸੇ ਦੀ ਭਾਵਨਾ ਦਾ ਪ੍ਰਗਟ ਸੀਗਾ ਜਲ੍ਹਿਆਂਵਾਲਾ ਬਾਗ ਦੀ ਘਟਨਾ ਜਦੋਂ ਕਿ ਪੰਜਾਬੀ ਲੋਕਾਂ ਵਿਖੇ ਇੱਕ ਪੰਗਵਾਰੀਆਂ ਅੱਗ ਬਲਦੀਆਂ ਲਾਸ਼ਾਂ ਨੂੰ ਮੰਚ ਨੂੰ ਸੰਭਾਲਣ ਲਈ ਇੱਕ ਮੀਟਿੰਗ ਹੋ ਰਹੀ ਸੀ ਊਧਮ ਸਿੰਘ ਨੇ ਉਸ ਅ ਅਦਾਲਤ ਦੇ ਜੱਜ ਨੂੰ ਲਗਾਤਾਰ ਮਾਰਪੀਟ ਕਰਨ ਦਾ ਆਰੋਪ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੇ ਜੀਵਨ ਦੀ ਸੁੱਖ ਲਈ ਸੀਗੀ ਸ਼ਹੀਦ ਊਧਮ ਸਿੰਘ ਨੇ ਇੱਕੀ ਸਾਲ ਤੋਂ ਬਾਅਦ ਤੇਰ੍ਹਾਂ ਮਾਰਚ ਉੱਨੀ ਸੌ ਚਾਲ੍ਹੀ ਨੂੰ ਉਧਮ ਸਿੰਘ ਨੇ ਲੰਡਨ ਵਿੱਚ ਮਾਈਕਲ ਆਡਵਾਇਰ ਦਾ ਕਤਲ ਕੀਤਾ ਅਡਵਾਇਰ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਲੈਫਟਨ ਗਵਰਨਰ ਸੀਗਾ ਅਤੇ ਉਸਨੂੰ ਕਤਲੇਆਮ ਦੀ ਹਿਮਾਇਤ ਕਰਨ ਅਤੇ ਜਰਨ ਜਨਰਲ ਡਾਇਰ ਦੀਆਂ ਕਾਰਵਾਈਆਂ ਦਾ ਸਮਰਥਨ ਕਰਨ ਲਈ ਜਿੰਮੇਦਾਰ ਮੰਨਿਆ ਗਿਆ ਸੀਗਾ ਮਾਈਕਲ ਆਡਵਾਇਰ ਦੀ ਹੱਤਿਆ ਅਤੇ ਊਧਮ ਸਿੰਘ ਦੇ ਕੰਮ ਨੂੰ ਬਹੁਤ ਸਾਰੇ ਲੋਕਾਂ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਪੀੜਤਾਂ ਲਈ ਬਦਲਾ ਅਤੇ ਨਿਆਂ ਦੀ ਕਾਰਵਾਈ ਵਜੋਂ ਦੇਖਿਆ ਸੀਗਾ ਸਹੀਦ ਊਧਮ ਸਿੰਘ ਨੇ ਮਾਇਕਲ ਆਡਵਾਇਰ ਦੀ ਹੱਤਿਆ ਦੇ ਲਗਭਗ ਵੀਹ ਦਿਨਾਂ ਬਾਅਦ ਇਕ ਅਪ੍ਰੈਲ ਉੱਨੀ ਸੌ ਚਾਲ੍ਹੀ ਨੂੰ ਊਧਮ ਸਿੰਘ ਨੂੰ ਰਸਮੀ ਦੋਸ਼ਾਂ ਦਾ ਸ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਜੇਲ੍ਹ ਵਿੱਚ ਹਿਰਾਸਤ ਵਿੱਚ ਲਿਆ ਗਿਆ